ਸਤਿ ਸ਼੍ਰੀ ਅਕਾਲ ਸਰ ਸਰ ਮੈਂ ਸਰਹੰਦ ਫਤਿਹਗੜ੍ਹ ਸਾਹਿਬ ਤੋਂ ਬੋਲ ਰਹੀ ਹਾਂ ਆਪਣੇ ਦਫਤਰ ਦੇ ਕੰਮ ਲਈ ਮੈਨੂੰ ਗੋਬਿੰਦਗੜ੍ਹ ਜਾਣਾ ਪੈ ਰਿਹਾ ਹੈ ਸਰਹੰਦ ਤੋਂ ਗੋਬਿੰਦਗੜ੍ਹ ਜਾਣ ਦੇ ਵਾਸਤੇ ਪੰਦਰ੍ਹਾਂ ਕੁ ਮਿੰਟ ਲੱਗਦੇ ਨੇ ਪਰ ਮੈਨੂੰ ਹੁਣ ਬਹੁਤ ਕਾਹਲੀ ਹੈ ਮੈਂ ਜਲਦੀ ਦੇ ਵਿੱਚ ਹਾਂ ਇਸ ਲਈ ਮੈਂ ਚਾਹੁੰਦੀ ਹਾਂ ਕਿ ਤੁਸੀਂ ਮੇਰੇ ਵਾਸਤੇ ਕੋਈ ਓਲਾ ਬੁੱਕ ਕਰੋ ਇਹ ਜਿਹੜੀ ਓਲਾ ਹੈ ਮੇਰੇ ਕੋਲ ਜੇ ਤੁਸੀਂ ਛੇਤੀ ਤੋਂ ਛੇਤੀ ਭਿਜਵਾ ਸਕੋ ਤਾਂ ਬਹੁਤ ਜ਼ਿਆਦਾ ਵਧੀਆ ਹੈ ਕਿਉਂਕਿ ਜੇ ਡਰਾਈਵਰ ਜਲਦੀ ਆਏਗਾ ਤਾਂ ਮੈਨੂੰ ਮੇਰਾ ਕੰਮ ਕਰਨ ਦੇ ਵਿੱਚ ਆਸਾਨੀ ਹੋ ਜਾਵੇਗੀ ਮੈਂ ਇਹ ਵੀ ਚਾਹੁੰਦੀ ਹਾਂ ਕਿ ਜਿਹੜਾ ਡਰਾਈਵਰ ਹੈ ਉਹ ਇਸ ਤਰ੍ਹਾਂ ਦਾ ਨਾ ਹੋਵੇ ਜਿਹੜਾ ਕਿ ਬਹੁਤ ਹੀ ਜ਼ਿਆਦਾ ਤੇਜ਼ ਗੱਡੀ ਚਲਾ ਕੇ ਕਿਸੇ ਦਾ ਨੁਕਸਾਨ ਕਰ ਦੇਵੇ ਹਾਲਾਂਕਿ ਮੈਨੂੰ ਜਾਣ ਦੀ ਜਲਦੀ ਹੈ ਪਰ ਫਿਰ ਵੀ ਮੈਂ ਇੱਕ ਗੱਲ ਜਿਹੜੀ ਹੈ ਉਹ ਦੱਸਣਾ ਚਾਹੁੰਦੀ ਹਾਂ ਕਿ ਮੈਨੂੰ ਇੱਕ ਇਸ ਤਰ੍ਹਾਂ ਦੇ ਡਰਾਈਵਰ ਦੀ ਲੋੜ ਹੈ ਜਿਹੜਾ ਕਿ ਆਪਣੀ ਗੱਡੀ ਨੂੰ ਉਹਦੀ ਸਪੀਡ ਜਿਹੜੀ ਹੈ ਉਹਨੂੰ ਧਿਆਨ ਦੇ ਵਿੱਚ ਰੱਖ ਕੇ ਜਾਵੇ ਅਤੇ ਤਾਂ ਕਿ ਕਿਸੇ ਦਾ ਕੋਈ ਨੁਕਸਾਨ ਵੀ ਨਾ ਹੋਵੇ ਅਤੇ ਸਾਡਾ ਕੰਮ ਵੀ ਹੋ ਜਾਵੇ ਮੈਂ ਉਮੀਦ ਕਰਦੀ ਹਾਂ ਕਿ ਤੁਸੀਂ ਮੇਰੇ ਲਈ ਇੱਕ ਵਧੀਆ ਓਲਾ ਜਿਹੜੀ ਹੈ ਉਹ ਭੇਜੋਗੇ ਤਾਂ ਕਿ ਮੈਂ ਆਪਣਾ ਕੰਮ ਕਰਕੇ ਆ ਸਕਾਂ ਧੰਨਵਾਦ